ਮੈਂ ਬੀਰਪਾਲ ਪਿੰਡ ਖਿਲਣ ਤੋਂ ਹਾਂ ਮੇਰਾ ਅੱਜ ਸਰਦੂਲਗੜ੍ਹ ਪੇਪਰ ਸੀ ਮੈਂ ਖਿਲਣ ਤੋਂ ਮੈਂ ਸਰਦੂਲਗੜ੍ਹ ਜਾਣਾ ਸੀ ਜਿਸ ਲਈ ਮੈਂ ਸਵੀਗੀ ਐਪ ਤੋਂ ਇੱਕ ਕੈਪ ਬੁੱਕ ਕੀਤੀ ਕੈਪ ਮੇਰੇ ਕੋਲ ਟਾਈਮ ਸਿਰ ਆ ਗਈ ਸੀ ਮੈਂ ਖਿਲਣ ਤੋਂ ਚਲ ਗਈ ਕੈਪ ਰਾਹੀਂ ਅਤੇ ਸਰਦੂਲਗੜ੍ਹ ਜਦੋਂ ਮੈਂ ਪਹੁੰਚੀ ਤਾਂ ਮੈਂ ਉਸਨੂੰ ਪੁੱਛਿਆ ਕਿ ਮੈਂ ਤੁਹਾਨੂੰ ਪੈਸੇ ਕਿਵੇਂ ਪੇ ਕਿਵੇਂ ਕਰਾਂ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਕੈਸ਼ ਜਮਾਂ ਕਰਾ ਸਕਦੇ ਹੋ ਪਰ ਮੇਰੇ ਕੋਲ ਕੈਸ਼ ਨਹੀਂ ਸੀ ਫਿਰ ਮੈਂ ਉਸ ਤੋਂ ਉਸਨੂੰ ਪੁੱਛਿਆ ਕਿ ਤੁਹਾਡੇ ਕੋਲ ਗੂਗਲ ਪੇ ਪੇ ਟੀ ਐਮ ਚਲਦਾ ਹੈ ਤਾਂ ਉਸਨੇ ਕਿਹਾ ਮੇਰੇ ਕੋਲ ਪੇਟੀਐਮ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਅੱਜ ਰਾਤ ਉਰੇ ਰਹਿਣਾ ਹੈ ਮੈਂ ਤੁਹਾਡਾ ਕੈਸ਼ ਕੱਲ੍ਹ ਨੂੰ ਦੇ ਦਊਗੀ ਕਢਵਾ ਕੇ ਪਰ ਉਸਨੇ ਕਿਹਾ ਨਹੀਂ ਮੈਨੂੰ ਹੁਣੇ ਹੀ ਚਾਹੀਦਾ ਹੈ ਫਿਰ ਮੈਂ ਨੇੜਿਓਂ ਦੀ ਕਰਿਆਨੇ ਦੇ ਸਟੋਰ ਤੋਂ ਜਾ ਕੇ ਗੂਗਲ ਪੇ ਕਰਕੇ ਮੈਂ ਉੱਥੋਂ ਪੇ ਲੈ ਕੇ ਆਈ ਅਤੇ ਮੈਂ ਉਸਨੂੰ ਪੈਸੇ ਦਿੱਤੇ